ਹਾਂਜੀ ਜਿੱਦਾਂ ਆਪਾਂ ਮੰਨਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਆ ਤੁਹਾਨੂੰ ਪਤਾ ਅੰਮ੍ਰਿਤਸਰ 'ਚ ਟੂਰਿਸਟ ਜ਼ਿਆਦਾ ਹੁੰਦਾ ਇੱਥੇ ਐਰੋਪਲੇਨ ਵੀ ਬਹੁਤ ਆ ਬੱਸਾਂ ਵੀ ਆਉਂਦੀਆਂ ਜਾਂਦੀਆਂ ਟਰੇਨਾਂ ਵੀ ਆਉਂਦੀਆਂ ਜਾਂਦੀਆਂ ਟੈਕਸੀ ਵੀ ਆਉਂਦੀਆਂ ਜਾਂਦੀਆਂ ਪਰ ਆਪਾਂ ਜੇ ਜ਼ਿਆਦਾ ਕਹੀਏ ਤਾਂ ਲੋਕ ਅੱਜ ਕੱਲ੍ਹ ਜ਼ਿਆਦਾ ਬੱਸਾਂ ਅਤੇ ਟ੍ਰੇਨਾਂ ਰਾਹੀਂ ਜ਼ਿਆਦਾਤਰ ਸਫਰ ਕਰਦੇ ਆ ਕਿਉਂਕਿ ਉਹਨਾਂ ਨੂੰ ਇਹ 'ਚ ਥੋੜ੍ਹਾ ਅਸਾਨ ਵੀ ਹੁੰਦਾ ਬੱਸਾਂ 'ਤੇ ਜਿਹੜੀਆਂ ਟ੍ਰੇਨਾਂ ਹੁੰਦੀਆਂ ਉਹਦੀਆਂ ਆਪਣੀ ਫਿਰ ਟਿਕਟ ਹੁੰਦੀ ਆ ਉਹ ਵੀ ਸਸਤੀ ਹੁੰਦੀ ਹੈ ਕਈ ਲੋਕ ਆ ਜਿਹੜੇ ਉਹ ਏਅਰਪਲੇਨ ਥਾਣੀ ਵੀ ਕਰਦੇ ਕਿਉਂਕਿ ਇਹਨਾਂ ਕੋਲ ਤੁਹਾਨੂੰ ਪਤਾ ਜਿਹੜੇ ਗਰੀਬ ਆ ਮਾਤੜ ਆ ਉਹਨਾਂ ਤੋਂ ਅਤੇ ਉਹਨਾਂ ਨੇ ਬੱਸ 'ਤੇ ਟਿਕਟ ਦਾ ਕਿਰਾਇਆ ਕਰ ਲੈਣਾ ਅਤੇ ਜਿਹੜੀ ਸਾਫ ਸਫਾਈ ਆ ਉਹ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਆ ਅੱਜ ਕੱਲ੍ਹ ਅੰਮ੍ਰਿਤਸਰ ਸ਼ਹਿਰ ਵਿੱਚ ਕਿਉਂਕਿ ਤੁਹਾਨੂੰ ਪਤਾ ਅੰਮ੍ਰਿਤਸਰ ਸ਼ਹਿਰ ਇਹ ਕਹੀਓ ਨਹੀਂ ਕਿ ਸ਼ਹਿਰ ਬਣ ਗਿਆ ਵਾ ਆਹ ਵਰਲਡ ਫੇਮਸ ਸ਼ਹਿਰ ਆ ਲੋਕ ਦੂਰੋਂ ਦੂਰੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਆ ਲੋਕ ਹੁਣ ਅੱਜ ਕੱਲ੍ਹ ਜਿੱਦਾਂ ਐਤਵਾਰ ਚੁਪਹਿਰਾ ਸਾਹਿਬ ਵੀ ਹੁੰਦਾ ਸ਼ਹੀਦਾਂ ਸਾਹਿਬ ਉੱਥੇ ਵੀ ਆਉਂਦੇ ਆ ਆਟੋਸ ਹੋ ਗਏ ਪਰ ਆਪਾਂ ਕਹੀਏ ਕਿ ਆਟੋਸ ਵਾਲੇ ਆ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਹੀ ਮਤਲਬ ਰਸ਼ ਪਾਇਆ ਹੁੰਦਾ ਐਤਵਾਰ ਉਹ ਲੋਕਾਂ ਨੂੰ ਜ਼ਿਆਦਾ ਲੁੱਟਦੇ ਆ ਪਰ ਆਪਾਂ ਕਹੀਏ ਵੀ ਪਰ ਕਿਹੜੇ ਆਪਣੀ ਐੱਸ ਜੀ ਪੀ ਸੀ ਵੱਲੋਂ ਇੱਕ ਨਵੀਂ ਬੱਸ ਚਲਾਈ ਗਈ